ਹੈਲੋ ਹਾਂਜੀ ਨਮਸਕਾਰ ਜੀ ਮੈਂ ਰਾਗਵ ਟਰੈਵਲਿੰਗ ਏਜੰਸੀ ਸੇ ਬੋਲ ਤੋਂ ਬੋਲ ਰਿਹਾ ਹਾਂ ਜੀ ਦੱਸੋ ਤੁਹਾਡੀ ਕੀ ਸੇਵਾ ਕਰ ਸਕਦਾ ਹਾਂਜੀ ਅੱਛਾ ਜੀ ਜੀ ਤੁਸੀਂ ਕਿੱਦਣ ਅਤੇ ਕਿੰਨੇ ਲੋ ਲੋਕਾਂ ਨੇ ਜਾਣਾ ਹੈ ਕਿੰਨੇ ਜਣਿਆ ਨੇ ਜਾਣਾ ਹੈ ਅੱਛਾ ਜੀ ਕਿੰਨੇ ਵਜੇ ਦਾ ਤੁਹਾਡਾ ਪਲੈਨ ਹੈ ਅੱਛਾ ਜੀ ਅਤੇ ਤੁਹਾਡਾ ਕੀ ਪਲੈਨ ਹੈ ਤੁਸੀਂ ਕਿੱਥੇ ਕਿੱਥੇ ਘੁੰਮਣਾ ਚਾਹੁੰਦੇ ਹੋ ਅਤੇ ਹਾਂਜੀ ਜੀ ਅੱਛਾ ਜੀ ਅਤੇ ਤੁਸੀਂ ਕਿੰਨੇ ਕੁ ਵਜੇ ਤੱਕ ਫ੍ਰੀ ਹੋ ਜਾਓਗੇ ਅਤੇ ਮੈਂ ਤੁਹਾਨੂੰ ਕਿੱਥੋਂ ਪਿਕਅਪ ਕਰਾਂ ਕੀ ਲੋਕੇਸ਼ਨ ਹੋਏਗੀ ਤੁਹਾਡੀ ਓਕੇ ਜੀ ਠੀਕ ਹੈ ਜੀ ਸਰ ਚਾਰ ਕੁ ਵਜੇ ਦੇ ਕਰੀਬ ਬਾਗਾ ਬੋਡਰ ਜਿਹੜਾ ਹੈ ਸਾਡੀ ਸੈਰੇਮਨੀ ਸਟਾਟ ਹੋ ਜਾਂਦੀ ਆ ਅਤੇ ਅਸੀਂ ਲਗਭਗ ਪੰਜ ਕੁ ਘੰਟੇ ਦੀ ਪਲੈਨਿੰਗ ਲੈ ਕੇ ਚਲਾਂਗੇ ਟਰੈਵਲਿੰਗ ਟਾਈਮ ਅਤੇ ਅਸੀਂ ਤੁਹਾਨੂੰ ਇੱਦਾਂ ਕਰਦੇ ਹਾਂ ਇਨੋਵਾ ਕਾਰ ਮੁਹੱਈਆ ਕਰਾ ਦਿੰਦੇ ਹਾਂ ਅਤੇ ਤੁਹਾਨੂੰ ਸਾਡਾ ਜੀ ਡਰਾਈਵਰ ਅਪਰੋਕਸੀਮੇਟ ਤਿੰਨ ਕੁ ਘੰਟੇ ਮਤਲਬ ਪੰਜ ਘੰਟੇ ਦੀ ਟਰੈਵਲਿੰਗ ਹੋਵੇਗੀ ਤੁਹਾਡੀ ਠੀਕ ਹੈ ਜੀ ਅਤੇ ਅਸੀਂ ਤੁਹਾਨੂੰ ਤਕਰੀਬਨ ਅੱਠ ਕੁ ਵਜੇ ਸਵੇਰੇ ਡਰਾਈਵਰ ਆਪਣਾ ਭੇਜ ਦਿਆਂਗੇ ਅਤੇ ਉਹ ਤੁਹਾਨੂੰ ਉੱਥੋਂ ਪਿਕਅਪ ਕਰ ਲਵੇਗਾ ਅਤੇ ਸਰ ਅਪਰੋਕਸੀਮੇਟ ਡਰਾਈਵਰ ਦੇ ਚਾਰਜਿਸ ਵੰਨ ਥਾਊਂਸੈਂਡ ਪਰ ਡੇ ਐਕਸਟਰਾ ਹੋਣਗੇ ਅਤੇ ਬਾਕੀ ਪਰ ਕਿਲੋਮੀਟਰ ਦੇ ਦਸ ਤੋਂ ਬਾਰਾਂ ਰੁਪਏ ਪਰ ਕਿਲੋਮੀਟਰ ਜੋ ਵੀ ਤੁਹਾਨੂੰ ਹੋਏਗਾ ਡਰਾਈਵਰ ਤੁਹਾਨੂੰ ਅਪਡੇਟ ਦੇਵੇਗਾ ਠੀਕ ਹੈ ਜੀ ਅਤੇ ਮੈਂ ਕਨਫਰਮੇਸ਼ਨ ਕਰਦਿਆਂ ਜੀ ਫਿਰ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਜੀ